ਮੇਰਾ ਨਾਮ ਅਮਿਤ ਕੁਮਾਰ ਹੈ ਅਤੇ ਮੈਂ ਆਪਣੇ ਘਰ ਦੇ ਵਿੱਚ ਆਪਣੇ ਘਰ ਦੇ ਬਾਹਰ ਇੱਕ ਕੂੜੇ ਦਾ ਡੱਬਾ ਰੱਖਿਆ ਹੋਇਆ ਕੂੜੇ ਦਾ ਡੱਬਾ ਚੋਰੀ ਹੋਣ ਕਾਰਨ ਰਿਪੋਰਟ ਦਰਜ ਕਰਾਉਣਾ ਚਾਹੁੰਦਾ ਹਾਂ ਮੇਰੇ ਘਰ ਦੇ ਮੂਹਰੇ ਵਾਲੀ ਗਲੀ ਦੇ ਵਿੱਚ ਕੂੜਾ ਕਰਕਟ ਸੁੱਟਣ ਲਈ ਇੱਕ ਡੱਬਏਆ ਡੱਬਾ ਰੱਖਿਆ ਹੋਇਆ ਸੀ ਜਿਹੜਾ ਕਿ ਅੱਜ ਜਿਹੜਾ ਕਿ ਕੱਲ੍ਹ ਰਾਤ ਚੋਰੀ ਹੋ ਗਿਆ ਹੈ ਉਸ ਡੱਬੇ ਨੂੰ ਬਿਨਾਂ ਕਿਸੇ ਬਿਨਾਂ ਕਿਸੇ ਤਾਲੇ ਦੇ ਨਾਲ ਜਾਂ ਬਿਨਾਂ ਕਿਸੇ ਜੰਜੀਰ ਨਾਲ ਰੱਖਿਆ ਹੋਇਆ ਸੀ ਜਿਹੜਾ ਕਿ ਲੋਹੇ ਦਾ ਬਣਿਆ ਹੋਇਆ ਸੀ ਜਿਹੜਾ ਕਿ ਰਾ ਕੱਲ੍ਹ ਰਾਤ ਦੇ ਸਮੇਂ ਚੋਰ ਆਏ ਅਤੇ ਉਸਨੂੰ ਚੁੱਕ ਕੇ ਲੈ ਗਏ ਮੈਂ ਚਾਹੁੰਦਾ ਹਾਂ ਕਿ ਮੇਰੇ ਘਰ ਦੇ ਗਲੀ ਦੇ ਸਾਹਮਣੇ ਇੱਕ ਨਵਾਂ ਕੂੜੇ ਦਾ ਡੱਬਾ ਰੱਖਿਆ ਜਾਵੇ ਜਿਹੜਾ ਕਿ ਗਿੱਲਾ ਅਤੇ ਸੁੱਕਾ ਅਲੱਗ ਅਲੱਗ ਕਰਨ ਵਾਲਾ ਹੋਵੇ ਅਤੇ ਉਸਦੇ ਰਾ ਉਸਦੇ ਨਾਲ ਉਸਨੂੰ ਤਾਲਾ ਲਿ ਲਾ ਦਿੱਤਾ ਜਾਵੇ ਕਿ ਜਿਸ ਨਾਲ ਕੋਈ ਵੀ ਉਸਨੂੰ ਚੁੱਕ ਕੇ ਨਾ ਲੈ ਕੇ ਜਾ ਸਕੇ ਮੇਰਾ ਘਰ ਕਪੂਰਥਲਾ ਦੇ ਪਿੰਡ ਨਾਗੋ ਦੇ ਵਿੱਚ ਹੈ